ਹੈਲੋ ਹੈਲੋ ਹਾਜੀ ਸਬਜ਼ੀਆਂ ਵਾਲੀ ਦੁਕਾਨ ਤੋਂ ਬੋਲਦੇ ਹੋ ਜੀ ਹਾਂਜੀ ਮੇਰਾ ਨਾਂ ਮਨਪ੍ਰੀਤ ਸਿੰਘ ਆ ਜੀ ਬਲਜਿੰਦਰ ਸਿੰਘ ਗੱਲ ਕਰਦੇ ਹੋ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਹਾਂਜੀ ਅਸੀਂ ਨਾ ਜੀ ਸਾਡੇ ਪ੍ਰੋਗਰਾਮ ਹੈ ਜੀ ਵੀ ਵਿਆਹ ਹੈਗਾ ਜੀ ਘਰ ਅਤੇ ਤੁਹਾਡੇ ਕੋਲੋਂ ਫਰੈਸ਼ ਸਬਜ਼ੀ ਕਿਹੜੀ ਮਿਲੂ ਵਧੀਆ ਸਬਜ਼ੀਆਂ ਜੀ ਤਾਜ਼ੀ ਸਬਜ਼ੀ ਦੀ ਜ਼ਰੂਰਤ ਆ ਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਅੱਛਾ ਜੀ

ਠੀਕ ਹੈ ਜੀ ਸਾਨੂੰ ਜ਼ਿਆਦਾਤਰ ਤਾਂ ਜੀ ਉਹ ਸਲਾਦ ਚਾਹੀਦਾ ਇੱਕ ਤਾਂ ਜੀ ਜ਼ਿਆਦਾਤਰ ਸਲਾਦ ਚਾਹੀਦਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਰੇਟ ਕੀ ਰੇਟ ਕੀ ਰੇਟ 'ਤੇ ਦਿਓਂਗੇ ਜੀ ਸਾਨੂੰ ਠੀਕ ਹੈ ਜੀ ਠੀਕ ਹੈ ਜੀ ਅਸੀਂ ਤਾਂ ਹੀ ਫੋਨ ਲਗਾਇਆ ਜੀ ਤੁਹਾਨੂੰ ਠੀਕ ਹੈ ਜੀ ਤੁਹਾਨੂੰ ਅਸੀਂ ਦੱਸ ਰਹੇ ਹਾਂ ਜੀ ਮੇਰਾ ਮੋਬਾਇਲ ਨੰਬਰ ਬਾਹਠ ਅੱਠ ਸੌ ਅਠਤਾਲੀ ਉੱਨੀ ਸੱਤ ਸੌ ਬਾਰਾਂ ਜੀ ਕੱਲ੍ਹ ਨੂੰ ਲੋੜ ਹੈ ਜੀ ਕੱਲ੍ਹ ਨੂੰ ਤੜਕੇ ਸੁਬਾ ਨੌਂ ਵਜੇ ਲੋੜ ਹੈ ਜੀ ਸਾਨੂੰ ਤੁਹਾਨੂੰ ਕਾਲ ਕਰ ਦਾਂਗੇ ਠੀਕ ਹੈ ਜੀ ਠੀਕ ਆ ਜੀ ਚੱਲ ਚੱਲ ਤੁਹਾਨੂੰ ਅਸੀਂ ਸੁਬਾ ਬ ਕਾਲ ਕਰਾਂਗੇ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਚੱਲ ਅਸੀ ਤੁਹਾਨੂੰ ਸੁਬਾ ਫੋਨ ਲਾਵਾਂਗੇ ਧੰਨਵਾਦ ਜੀ ਕਾਲ ਚੁੱਕਣ ਲਈ